ਸਾਡੇ ਇਲਾਕੇ ਵਿੱਚ ਵਧੀਆ ਜ਼ੀਲਡਿੰਗ ਫਸਲ ਕਣਕ ਹੈ ਇਹ ਇੱਕ ਘਾਹ ਪ੍ਰਜਾਤੀ ਦੀ ਫਸਲ ਹੈ ਜੋ ਕਿ ਪੂਰੀ ਦੁਨੀਆਂ ਵਿੱਚ ਇੱਕ ਵਿਸ਼ਵ ਵਿਆਪੀ ਮੁੱਖ ਭੋਜਨ ਹੈ ਮੱਕੀ ਤੋਂ ਬਾਅਦ ਇਹ ਦੁਨੀਆਂ ਭਰ ਵਿੱਚ ਉਗਾਈ ਜਾਣ ਵਾਲੀ ਦੂਸਰੀ ਵੱਡੀ ਅਨਾਜ ਦੀ ਫਸਲ ਹੈ ਤੀਸਰੇ ਪੱਧਰ 'ਤੇ ਝੋਨੇ ਚੌਲ ਦੀ ਫਸਲ ਆਉਂਦੀ ਹੈ ਕਣਕ ਕਿਸੇ ਵੀ ਹੋਰ ਖੁਰਾਕੀ ਫਸਲ ਦੋ ਸੌ ਵੀਹ ਪੁਆਇੰਟ ਚਾਰ ਮਿਲੀਅਨ ਹੈਕਟੇਅਰ ਜਾਂ ਪੰਜ ਸੌ ਪੰਤਾਲੀ ਮਿਲੀਅਨ ਏਕੜ ਦੋ ਹਜ਼ਾਰ ਚੌਦ੍ਹਾਂ ਨਾਲੋਂ ਵੱਧ ਜ਼ਮੀਨੀ ਖੇਤਰ 'ਤੇ ਉਗਾਈ ਜਾਂਦੀ ਹੈ ਕਣਕ ਦਾ ਵਿਸ਼ਵ ਵਪਾਰ ਬਾਕੀ ਸਾਰੀਆਂ ਫਸਲਾਂ ਨਾਲੋਂ ਵੱਧ ਹੈ ਕਣਕ ਆਟਾ ਬਣਾਉਣ ਲਈ ਵਰਤੀ ਜਾਂਦੀ ਹੈ ਜੋ ਕਿ ਇੱਕ ਮਨ ਭਾਉਂਦਾ ਖਾਣਾ ਹੈ ਇਹ ਜਾਨਵਰ ਖੁਰਾਕ ਲਈ ਵੀ ਵਰਤੀ ਜਾਨਵਰਾਂ ਦੇ ਖੁਰਾਕ ਲਈ ਵਰਤੀ ਜਾਂਦੀ ਹੈ ਅਤੇ ਬੀਅਰ ਕੱਢਣ ਵਿੱਚ ਵੀ ਇੱਕ ਜ਼ਰੂਰੀ ਅੰਗ ਦੇ ਤੌਰ 'ਤੇ ਵਰਤੀ ਜਾਂਦੀ ਹੈ ਸ਼ਿਰਕਾ ਵੱਖਰਾ ਕਰਕੇ ਸ਼ਾਨ ਪੂਰਾ ਪੀਹ ਕੇ ਪੀਹ ਕੇ ਵੀ ਵਰਤੋਂ ਵਿਚ ਲਿਆਉਂਦਾ ਜਾਂਦਾ ਹੈ ਕਣਕ ਦੀ ਬਿਜਾਈ ਹਰੇ ਜਾਂ ਸੁੱਕੇ ਚਾਰੇ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ ਭਾਰਤ ਵਿੱਚ ਪ੍ਰਮੁੱਖ ਰੱਬੀ ਫਸਲ ਕਣਕ ਹੈ ਇਸ ਤੋਂ ਇਲਾਵਾ ਰਾਈ ਸਰ੍ਹੋਂ ਤੇਲ ਅਤੇ ਮਟਰ ਵੀ ਬੀਜਿਆ ਜਾਂਦੇ ਹਨ ਕਣਕ ਦੀ ਫਸਲ ਇੱਕ ਪ੍ਰਸਿੱਧ ਅਤੇ ਮੁੱਖ ਅਨਾਜ ਹੈ ਕਣਕ ਨੂੰ ਗੁੰਦਾਂ ਗੰਦਮ ਗੇਂਹੂ ਵੀ ਕਹਿੰਦੇ ਹਨ ਕਣਕ ਦੇ ਨਾੜ ਦੇ ਉੱਤਲੇ ਸਿਰੇ ਉੱਤੇ ਦਾਣਿਆਂ ਵਾਲਾ ਸਿੱਟਾ ਲੱਗਦਾ ਹੈ ਇਹ ਸਿੱਟਾ ਕਸੀਰਾ ਵਾਲਾ ਹੁੰਦਾ ਹੈ ਸਭ ਤੋਂ ਜ਼ਿਆਦਾ ਕਣਕ ਦਾ ਅੰਨ ਖਾਧਾ ਜਾਂਦਾ ਹੈ ਸਾਬਤ ਕਣਕ ਨੂੰ ਭੁੰਨਾ ਵਿੱਚ ਗੁੜ ਰਲਾ ਕੇ ਭੂਤ ਭਿੰਨੇ ਮਰੂੰਡੇ ਬਣਾ ਕੇ ਖਾਧੇ ਜਾਂਦੇ ਹਨ ਕਣਕ ਨੂੰ ਉਬਾਲ ਕੇ ਗੁੜ ਸ਼ੱਕਰ ਪਾ ਕੇ ਵੀ ਖਾਧਾ ਜਾਂਦਾ ਹੈ ਕਣਕ ਦਾ ਦਲੀਆ ਬਣਾ ਕੇ ਵੀ ਖਾਂਦੇ ਹਨ ਕਣਕ ਦੇ ਕਣਕ ਦੇ ਆਟੇ ਦੀ ਰੋਟੀ ਬਣਾ ਕੇ ਖਾਧੀ ਜਾਂਦੀ ਹੈ ਰੋਟ ਬਣਾ ਕੇ ਖਾਧਾ ਜਾਂਦਾ ਹੈ ਇਸਦੇ ਪਰੌਂਠੇ ਵੀ ਬਣਾਏ ਜਾਂਦੇ ਹਨ ਪੂਰੀ ਕੜਾਹ ਗੁਲਗੁਲੇ ਪੂੜੇ ਮਾਲ ਪੂੜੀਆਂ ਸੇਵੀਆਂ ਬਿਸਕੁਟ ਅਤੇ ਹੋਰ ਬਹੁਤ ਸਾਰੇ ਖਾਣ ਪਦਾਰਥ ਕਣਕ ਤੋਂ ਬਣਦੇ ਹਨ